ਹਾਂਜੀ ਹਾਂਜੀ ਨਮਸਕਾਰ ਅੱਛਾ ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਨੂੰਮਾਨ ਚੌਂਕ ਤੋਂ ਲਾਗੇ ਫਿਸ਼ ਪਾਰਕ ਹੈਗੀ ਹੈ ਜੀ ਜਿੱਦਾਂ ਹਨੂੰਮਾਨ ਚੌਂਕ ਤੋਂ ਜਹਾਜ਼ ਚੌਂਕ ਜਹਾਜ਼ ਚੌਂਕ ਨੂੰ ਜਾਈਏ ਫਿਰ ਥੋੜ੍ਹਾ ਜਿਹਾ ਅੱਗੇ ਜਾਈਏ ਬਸ ਪੰਜ ਸੱਤ ਮਿੰਟ ਦਾ ਤੁਰ ਕੇ ਰਸਤਾ ਆ ਫਿਰ ਅੱਗੇ ਫਿਸ਼ ਪਾਰਕ ਆ ਬੜੀ ਵੱਡੀ ਬੜੀ ਵਧੀਆ ਫਸੈਲਟੀ ਫਸਿਲਟੀਆਂ ਨੇ ਉੱਥੇ ਬਹੁਤ ਵਧੀਆ ਘੁੰਮਣ ਫਿਰਨ ਨੂੰ ਐਕਸਸਾਈਜ਼ ਕਰਨ ਨੂੰ ਕਸਰਤ ਕਰਨ ਨੂੰ ਸਾਰਾ ਕੁਛ ਹਾਂਜੀ ਹਾਂਜੀ ਆਟੋ ਵੀ ਜਾ ਸਕ ਆਟੋ ਵੀ ਜਾਂਦੇ ਨੇ ਤੁਰ ਕੇ ਵੀ ਜਾ ਸਕਦੇ ਤੁਸੀਂ ਜ਼ਿਆਦਾ ਦੂਰ ਤਾਂ ਨਹੀਂ ਆ ਹਾਂਜੀ ਹਾਂਜੀ ਜਾਂਦੇ ਨੇ ਬਹੁਤ ਲੋਕ ਜਾਂਦੇ ਨੇ ਉੱਥੇ ਸਵੇਰੇ ਸ਼ਾਮ ਕਸਰਤ ਕਰਨ ਜਾਂਦੇ ਸੈਰ ਕਰਨ ਜਾਂਦੇ ਨੇ ਚਲ ਜਿਓ ਤੁਸੀਂ ਵੀ

ਨਹੀਂ ਜ਼ਿਆਦਾ ਮੇਨ ਤਾਂ ਉਹੀ ਹੈ ਸਿਟੀ ਦੇ ਵਿੱਚ ਫਿਸ਼ ਪਾਰਕ ਹਾਂਜੀ ਉੱਥੇ ਜਾ ਕੇ ਲੋਕ ਮਤਲਬ ਬਾਹਰੋਂ ਟੂਰਿਸਟ ਆਉਂਦੇ ਨੇ ਲੋਕ ਮਤਲਬ ਪਿਕਨਿਕ ਮਨਾਉਂਦੇ ਫੋਟੋਆਂ ਖਿੱਚਦੇ ਨੇ ਸੈਲੀਬਰੇਟ ਕਰਦੇ ਵਧੀਆ ਪਾਰਕ ਆ ਕਾਫੀ ਵੱਡੀ ਬਣੀ ਆ ਪਾਰਕ ਜਿਹੜੇ ਇੱਥੋਂ ਦੇ ਲੋਕਲ ਪਰਸਨ ਨੇ ਉਹ ਜਾਂਦੇ ਨੇ ਰੋਜ਼ ਕਸਰਤ ਕਰਨ ਸਵੇਰੇ ਸ਼ਾਮ ਤਾਜ਼ੀ ਹਵਾ ਮਿਲਦੀ ਉੱਥੇ ਝੂਲੇ ਵੀ ਨੇ ਹਮ ਬਹੁਤ ਨਹੀਂ ਨਹੀਂ ਕੋਈ ਦਿੱਕਤ ਨਹੀਂ ਆ ਸੇਫਟੀ ਆ ਬਹੁਤ ਸਕਿਓਰਟੀ ਵੀ ਹੁੰਦੀ ਆ ਉੱਥੇ ਹਾਂ ਹਾਂਜੀ ਹਾਂਜੀ ਜਦੋਂ ਮਰਜ਼ੀ ਜਾ ਸਕਦੇ ਤੁਸੀਂ ਖੁੱਲ੍ਹਾ ਹੀ ਹੁੰਦਾ ਉਹ ਰਾਤ ਦਸ ਵਜੇ ਤੱਕ ਹਮ ਸਵੇਰੇ ਜਾਓ ਸ਼ਾਮ ਨੂੰ ਜਾਓ ਰਾਤ ਨੂੰ ਜਾਓ ਹਾਂਜੀ ਹਾਂਜੀ ਓਕੇ ਓਕੇ ਠੀਕ ਹੈ ਠੀਕ ਠੀਕ ਓਕੇ